ਸਾਡੇ ਖੇਤਰ ਵਿੱਚ ਹੁਣ ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲਿਆ ਹੈ ਖੇਡਾਂ ਖੇਡਣ ਲਈ ਪਹਿਲਾਂ ਜ਼ਮਾਨੇ ਵਿੱਚ ਸਿਰਫ ਇਹ ਅਧਿਕਾਰ ਮੁੰਡਿਆਂ ਨੂੰ ਹੀ ਹੁੰਦਾ ਸੀ ਪਰ ਜਿਵੇਂ ਜਿਵੇਂ ਸਮਾਂ ਬਦਲਿਆ ਨਵੀਆਂ ਨਵੀਆਂ ਖੇਡਾਂ ਆਈਆਂ ਅਤੇ ਇਹ ਹੱਕ ਸਾਰਿਆਂ ਨੂੰ ਮਿਲਿਆ ਸਾਡੇ ਸਾਡੇ ਖੇਤਰ ਵਿੱਚ ਬਹੁਤ ਸਾਰੀਆਂ ਨੀਤੀਆਂ ਲਾਗੂ ਕੀਤੀਆਂ ਜਿਵੇਂ ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲਿਆ ਖੇਡਾਂ ਖੇਡਣ ਲਈ ਸਕੂਲਾਂ ਕਾਲਜਾਂ ਵਿੱਚ ਇਹ ਚੀਜ਼ ਕੰਪਲਸਰੀ ਕਰ ਦਿੱਤੀ ਕਿ ਸਾਰੇ ਕਿਤੇ ਖੇਡਾਂ ਖਿਡਾਉਣੀਆਂ ਜ਼ਰੂਰੀ ਹਨ ਉੱਥੇ ਸਮਾਨ ਵੀ ਆ ਗਿਆ ਅਤੇ ਉੱਥੇ ਬਾਹਰੋਂ ਕੈਂਪ ਲੱਗਦੇ ਨੇ ਅਤੇ ਬਾਹਰੋਂ ਟੀਚਰ ਆਉਂਦੇ ਨੇ ਅਤੇ ਸਾਨੂੰ ਖੇਡਾਂ ਖਿਡਾਉਣ ਲਈ ਉਹ ਉੱਚੇ ਪੱਧਰਾਂ 'ਤੇ ਲੈ ਲੈ ਕੇ ਜਾਂਦੇ ਨੇ ਅਤੇ ਉੱਥੇ ਸਾਨੂੰ ਵਧੀਆ ਡਾਈਟ ਡਾਈਟ ਮਿਲਦੀ ਹੈਗੀ ਅਤੇ ਬੋ ਪਰ ਬਹੁਤ ਸਾਰੇ ਖੇਤਰ ਅਜਿਹੇ ਵੀ ਨੇ ਜਿੱਥੇ ਹਜੇ ਇਹ ਹੱਕ ਪੂਰੀ ਤਰ੍ਹਾਂ ਮੁੰਡੇ ਕੁੜੀਆਂ ਨੂੰ ਨਹੀਂ ਮਿਲਿਆ ਉਹਨਾਂ ਦੇ ਘਰਦਿਆਂ ਵੱਲੋਂ ਜਾਂ ਉਹ ਖੁਦ ਇਹ ਖੇਡਾਂ ਨਹੀਂ ਖੇਡਣੀਆਂ ਚਾਹੁੰਦੀਆਂ ਉਹ ਸਾਰਾ ਦਿਨ ਪੜ੍ਹਾਈ ਦੇ ਵਿੱਚ ਲੱਗੇ ਰਹਿੰਦੇ ਨੇ ਤਾਂ ਇਹ ਗੱਲ ਗਲਤ ਹੈ ਸਾਰਾ ਦਿਨ ਪੜ੍ਹਾਈ ਵੀ ਜ਼ਰੂਰੀ ਨਹੀਂ ਹੈਗੀਗੀ ਬਲਕੀ ਖੇਡਾਂ ਖੇਡਣੀਆਂ ਸਾਡੇ ਲਈ ਉਨੀਆਂ ਹੀ ਜ਼ਰੂਰੀ ਨੇ ਜਿੰਨੀ ਸਾਡੇ ਲਈ ਪੜ੍ਹਾਈ ਜ਼ਰੂਰੀ ਹੈਗੀ ਧੰਨਵਾਦ